ਸਤਿ ਸ਼੍ਰੀ ਅਕਾਲ ਜੀ ਹਾਂਜੀ ਜਦੋਂ ਅਸੀਂ ਆਪਾਂ ਕੋਈ ਵੀ ਪੇਂਟਿੰਗ ਬਣਾਉਂਦੇ ਹਾਂ ਜਾਂ ਕੋਈ ਵੀ ਤਸਵੀਰ ਬਣਾਉਂਦੇ ਹਾਂ ਉਸਦੇ ਵਿੱਚ ਪੇਂਟਿੰਗ ਬ੍ਰੱਸ਼ਾਂ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਪੇਂਟਿੰਗ ਬ੍ਰੱਸ਼ ਇਸਤੇਮਾਲ ਕਰਦੇ ਹਾਂ ਜਿਵੇਂ ਨਿੱਕੀਆਂ ਥਾਵਾਂ ਭਰਨ ਵਾਸਤੇ ਤੇ ਛੋਟੇ ਬ੍ਰੱਸ਼ਾਂ ਦਾ ਇਸਤੇਮਾਲ ਕਰਦੇ ਹਾਂ ਬ੍ਰੱਸ਼ਾਂਤੇ ਵੱਡੀਆਂ ਵਾਸਤੇ ਅਸੀਂ ਵੱਡੇ ਬ੍ਰੱਸ਼ਾਂ ਦਾ ਇਸਤੇਮਾਲ ਕਰਦੇ ਹਾਂ ਇਸੇ ਤਰ੍ਹਾਂ ਕਈ ਪ੍ਰਕਾਰ ਦੇ ਪੇਂਟਿੰਗ ਬ੍ਰੱਸ਼ ਹੁੰਦੇ ਹਨ ਜੋ ਝਾੜੀਆਂ ਬਣਾਉਣ ਵਾਸਤੇ ਆਪਾਂ ਅਲੱਗ ਤਰ੍ਹਾਂ ਦੇ ਪੇਂਟਿੰਗ ਬ੍ਰੱਸ਼ ਇਸਤੇਮਾਲ ਕਰਦੇ ਹਾਂ ਸਿਤਾਰੇ ਬਣਾਉਣ ਵਾਸਤੇ ਅਸੀਂ ਅਲੱਗ ਤਰ੍ਹਾਂ ਦੇ ਪੇਂਟਿੰਗ ਬ੍ਰੱਸ਼ ਇਸਤੇਮਾਲ ਕਰਦੇ ਹਾਂ ਅਤੇ ਇਸ ਤਰ੍ਹਾਂ ਹੀ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਪੇਂਟਿੰਗ ਚਾਕੂਆਂ ਦਾ ਵੀ ਇਸਤੇਮਾਲ ਕਰਦੇ ਹਾਂ ਪੇਟਿੰਗ ਕਰਦੇ ਵਕਤ ਇਹਨਾਂ ਦਾ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਸੇ ਵੀ ਪੇਂਟਿੰਗ ਨੂੰ ਉਸਦੇ ਇੱਕ ਵਧੀਆ ਰੰਗ ਭਰਨ ਵਾਸਤੇ ਜਾਂ ਉਹਨੂੰ ਨਿਖਾੜਨ ਵਾਸਤੇ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਬ੍ਰੱਸ਼ਾਂ ਦਾ ਇਸਤੇਮਾਲ ਕਰਦੇ ਹਾਂ ਜੇ ਅਸੀਂ ਇੱਕ ਹੀ ਤਰ੍ਹਾਂ ਦੇ ਬ੍ਰੱਸ਼ ਦੇ ਨਾਲ ਕੰਮ ਕਰਦੇ ਹਾਂ ਤਾਂ ਉਹ ਪੇਂਟਿੰਗ ਇੰਨੀ ਵਧੀਆ ਨਹੀਂ ਬਣਦੀ ਅਤੇ ਸਾਨੂੰ ਨਿੱਕੀਆਂ ਥਾਵਾਂ 'ਤੇ ਰੰਗ ਭਰਨਾ ਔਖਾ ਹੋ ਜਾਂਦਾ ਹੈ ਅਤੇ ਉਸ ਪੇਂਟਿੰਗ ਨੂੰ ਚੰਗੀ ਤਰ੍ਹਾਂ ਨਿਖਾਰਨਾ ਵੀ ਬਹੁਤ ਔਖਾ ਹੋ ਜਾਂਦਾ ਹੈ ਇਸ ਤਰ੍ਹਾਂ ਅਸੀਂ ਸਭ ਤੋਂ ਛੋਟੇ ਬ੍ਰੱਸ਼ਾਂ ਦਾ ਇਸਤੇਮਾਲ ਕਰਦੇ ਹਾਂ ਉਸ ਸਮੇਂ ਜਿਵੇਂ ਕਿ ਛੋਟੇ ਬ੍ਰੱਸ਼ ਟ੍ਰਿਪਲ ਜੀਰੋ ਤੋਂ ਸ਼ੁਰੂ ਹੋ ਜਾਂਦੇ ਹਨ ਅਤੇ ਸਾਨੂੰ ਇਸ ਤੋਂ ਵੱਡੇ ਤੋਂ ਵੱਡੇ ਬ੍ਰੱਸ਼ ਵੀ ਮਿਲ ਸਕਦੇ ਹਨ ਇਸ ਤਰ੍ਹਾਂ ਹੀ ਹਾਂ ਕ ਸਾਨੂੰ ਅਲੱਗ ਅਲੱਗ ਤਰ੍ਹਾਂ ਬ੍ਰਾਂਡ ਕੰਪਨੀਆਂ ਦੇ ਬ੍ਰੱਸ਼ ਮਿਲਦੇ ਹਨ ਪਰ ਜੋ ਮੈਨੂੰ ਸਭ ਤੋਂ ਵਧੀਆ ਕੰਪਨੀ ਦੇ ਬ੍ਰੱਸ਼ ਲੱਗਦੇ ਹਨ ਉਹ ਕੈਮਲ ਕੰਪਨੀ ਦੇ ਲੱਗਦੇ ਹਨ ਕਿਉਂਕਿ ਉਸ ਵਿੱਚ ਸਾਨੂੰ ਬਹੁਤ ਅਲੱਗ ਤਰ੍ਹਾਂ ਦੇ ਬ੍ਰੱਸ਼ਾਂ ਦੀਆਂ ਅਕਾ ਬ੍ਰੱ ਆਕਾਰ ਦੇ ਬ੍ਰੱਸ਼ ਮਿਲ ਜਾਂਦੇ ਹਨ ਅਤੇ ਬਹੁਤ ਹੀ ਉਹ ਮੁਲਾਇਮ ਹੁੰਦੇ ਹਨ ਅਤੇ ਉਹਨਾਂ ਦੇ ਨਾਲ ਮੈਨੂੰ ਕੰਮ ਕਰਨਾ ਸੌਖਾ ਪੈ ਜਾਂਦਾ ਹੈ ਅਤੇ ਜਿੰਨ ਉਹ ਬ੍ਰੱਸ਼ ਜਲਦੀ ਖ਼ਰਾਬ ਵੀ ਨਹੀਂ ਹੁੰਦੇ ਹਨ ਕਿਉਂਕਿ ਕਈ ਬ੍ਰੱਸ਼ ਹੁੰਦੇ ਹਨ ਉਹ ਛੇਤੀ ਹੀ ਖ਼ਰਾਬ ਹੋ ਜਾਂਦੇ ਹਨ ਪਰ ਆਹ ਉਹ ਕੈਮਲ ਕੰਪਨੀ ਦੇ ਜੋ ਬ੍ਰੱਸ਼ ਹਨ ਉਹ ਬਹੁਤ ਲੰਬੇ ਸਮੇਂ ਤੱਕ ਚੱਲਦੇ ਹਨ ਅਤੇ ਵਧੀਆ ਰਹਿੰਦੇ ਹਨ ਇਸ ਤਰ੍ਹਾਂ ਹੀ ਆਪਾਂ ਬਹੁਤ ਅਲੱਗ ਅਲੱਗ ਪੇਂਟਿੰਗ ਬ੍ਰੱਸ਼ਾਂ ਦੇ ਨਾਲ ਆਪਾਂ ਆਪਣੀ ਤਸਵੀਰ ਦੇ ਵਿੱਚ ਜਾਨ ਪਾ ਦਿੰਦੇ ਹਾਂ ਧੰਨਵਾਦ ਜੀ